ਸਤਿ ਸ਼੍ਰੀ ਅਕਾਲ ਸਰ ਮੈਂ ਮਿਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਅਤੇ ਸਾਡੀ ਇੱਕ ਨਿੱਕੀ ਜਿਹੀ ਪੈਲੀ ਜਾਂ ਫਾਰਮ ਹੈ ਜਿਸ ਵਿੱਚ ਅਸੀਂ ਫਸਲ ਉਗਾਈ ਹੋਈ ਹੈ ਅਤੇ ਜਿਸ ਵਿੱਚ ਕਈ ਤਰ੍ਹਾਂ ਕਈ ਵਾਰ ਕਈ ਤਰ੍ਹਾਂ ਦੇ ਪਸ਼ੂ ਆ ਕੇ ਨੁਕਸਾਨ ਕਰ ਚੁੱਕੇ ਹਨ ਅਤੇ ਜਿਵੇਂ ਅਵਾਰਾ ਪਸ਼ੂ ਅੱਗੇ ਗਾਈਆਂ ਵਗੈਰਾ ਆਦਿ ਆ ਜਾਂਦੇ ਹਨ ਜੋ ਕਿ ਸਾਡੀ ਫਸਲ ਦਾ ਬਹੁਤ ਨੁਕਸਾਨ ਕਰਦੇ ਹਨ ਅਤੇ ਸਾਨੂੰ ਇਹਨਾਂ ਤੋਂ ਬਚਾਅ ਲਈ ਅਸੀਂ ਇਹਨਾਂ ਤੋਂ ਬਚਾਅ ਲਈ ਆਪਣੀ ਪੈਲੀ ਦੇ ਆਲੇ ਦੁਆਲੇ ਬਾਉਂਡਰੀ ਵਗੈਰਾ ਬਣਾਈ ਹੋਈ ਹੈ ਜਿਵੇਂ ਕਿ ਕਈ ਵਾਰੀ ਪਰਾਲੀ ਦੇ ਬੁੱਤ ਵੀ ਲਗਾਏ ਜਾਂ ਲਗਾਏ ਲਗਾਏ ਜਾਂਦੇ ਹਨ ਅਤੇ ਕਈ ਵਾਰ ਕਾਂ ਕੂਦਰ ਬਣਾ ਕੇ ਜੋ ਕਿ ਅਵਾਰਾ ਪਸ਼ੂ ਉਹਨਾਂ ਤੋਂ ਡਰ ਜਾਣ ਇਸ ਕਰਕੇ ਲਗਾਏ ਜਾਂਦੇ ਹਨ ਕਈ ਵਾਰ ਇਹ ਜਾਨਵਰ ਸਾਡੀ ਪੈਲੀ ਵਿੱਚ ਆ ਕੇ ਬਹੁਤ ਹੀ ਫਸਲ ਦਾ ਨੁਕਸਾਨ ਕਰਦੇ ਹਨ ਜਿਸ ਕਾਰਨ ਸਾਨੂੰ ਕਈ ਤੰਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਮਿਹਨਤ ਬੇਕਾਰ ਹੋ ਜਾਂਦੀ ਹੈ ਅਤੇ ਇਹਨਾਂ ਪਸ਼ੂਆਂ ਨੂੰ ਪਸ਼ੂਆਂ ਤੋਂ ਬਚਾਅ ਕਰਨ ਲਈ ਕਈ ਤਰ੍ਹਾਂ ਦੇ ਉਪਾਏ ਕੀਤੇ ਜਾਂਦੇ ਹਨ